ਮੈਂ ਤੁਠ ਕੁਛ ਦਿਨਾਂ ਪਹਿਲੇ ਮੈਂ ਪੰਜ ਦਿਨਾਂ ਪਹਿਲਾਂ ਇੱਕ ਆਪਣਾ ਸਵੈਟਰ ਮੰਗਵਾਇਆ ਸੀ ਜੋ ਕਿ ਮੈਨੂੰ ਬਹੁਤ ਵਧੀਆ ਲੱਗਿਆ ਔਨਲਾਈਨ ਮਿੰਤਰਾ 'ਤੇ ਮਿੰਤਰਾ ਐਪ ਬਹੁਤ ਵਧੀਆ ਵਾ ਉਹ ਮੈਨੂੰ ਬਹੁਤ ਵਧੀਆ ਲੱਗੀ ਉੱਥੇ ਮੈਨੂੰ ਸਵੈਟਰ ਬਹੁਤ ਪਸੰਦ ਆਇਆ ਅਤੇ ਮੈਂ ਉਹ ਔਡਰ ਕੀਤਾ ਅਤੇ ਉਹ ਕੁਛ ਉਹਦੇ ਵਿੱਚ ਸਾਈਜ਼ ਵੀ ਬਹੁਤ ਸੀ ਐਕਸਲ ਤੋਂ ਲੈ ਕੇ ਡਬਲ ਐਕਸਲ ਤੱਕ ਜੋ ਕਿ ਮੈਨੂੰ ਬਹੁਤ ਪਸੰਦ ਆਇਆ ਕਲਰ ਵੀ ਬਹੁਤ ਵਾਈਬਰੈਂਟ ਸੀ ਅਤੇ ਫਿਰ ਮੈਂ ਉਹਨੂੰ ਔਡਰ ਕੀਤਾ ਅਤੇ ਫਿਰ ਉਹ ਦਸ ਦਿਨਾਂ ਦੀ ਡਿਲਵਰੀ ਦਿੰਦਾ ਪਿਆ ਸੀ ਪਰ ਉਹ ਮੈਨੂੰ ਕੁਛ ਹੀ ਦਿਨਾਂ 'ਚ ਪੰਜ ਦਿਨਾਂ 'ਚ ਹੀ ਮੈਨੂੰ ਡਿਲੀਵਰ ਹੋ ਗਿਆ ਜੋ ਕਿ ਮੈਂ ਸ ਵੇਖ ਕੇ ਮੈਂ ਬਹੁਤ ਵਧੀ ਮੈਨੂੰ ਵਧੀਆ ਲੱਗਿਆ ਕਿ ਇੰਨੀ ਜਲਦੀ ਆ ਗਿਆ ਮੇਰਾ ਸਵੈਟਰ ਉਸ ਤੋਂ ਅ ਮੈਨੂੰ ਉਹ ਡਿਲੀਵਰੀ ਮੈਨ ਵੀ ਬਹੁਤ ਵਧੀਆ ਲੱਗਿਆ ਡਿਲੀਵਰੀ ਮੈਨ ਵੀ ਬਹੁਤ ਵਧੀਆ ਸੀ ਅਤੇ ਬੜਾ ਹੈ ਉਹਨ ਮੇਰੇ ਘਰ ਤੱਕ ਉਹ ਸਵੈਟਰ ਦੇ ਗਿਆ ਮੈਨੂੰ ਬਹੁਤ ਵਧੀਆ ਲੱਗਿਆ ਉਸ ਤੋਂ ਬਾਅਦ ਮੈਂ ਸਵੈਟਰ ਖੋਲ੍ਹਿਆ ਤਾਂ ਬਿਲਕੁਲ ਉਦਾਂ ਦਾ ਸੀ ਜਿੱਦਾਂ ਦਾ ਮੈਂ ਵੇਖਿਆ ਸੀ ਅਤੇ ਬਿਲਕੁਲ ਫਿਟ ਆਇਆ ਇੰਨਾ ਵਧੀਆ ਸੀ ਉਹ ਮੈਨੂੰ ਮਤਲਬ ਐਪ ਬਹੁਤ ਵਧੀਆ ਲੱਗੀ ਪਹਿਲੇ ਮੈਂ ਸੋਚਦੀ ਪਈ ਸੀ ਲੈਣ ਤੋਂ ਪਹਿਲਾਂ ਕਿ ਮੈਂ ਜਾ ਕੇ ਖੁਦ ਖਰੀ ਖਰੀਦਾਂ ਪਰ ਨਹੀਂ ਮੈਂ ਬਾਅਦ 'ਚੋਂ ਮੈਨੀ ਉੱਥੇ ਸੇਲ ਲੱਗੀ ਹੋਈ ਸੀ ਅਤੇ ਮੈਨੂੰ ਪੰਜ ਹਜ਼ਾਰ ਦਾ ਸਵੈਟਰ ਦੋੋ ਹਜ਼ਾਰ 'ਚ ਮਿਲ ਗਿਆ ਜੋ ਕਿ ਬਹੁਤ ਮਤਲਬ ਵਧੀਆ ਪ੍ਰਾਈਜ਼ 'ਚ ਮੈਨੂੰ ਮਿਲ ਗਿਆ ਅਤੇ ਅ ਵੈਸੇ ਵੀ ਮਿੰਤਰਾ 'ਤੇ ਵੈਸੇ ਵੀ ਸੇਲ ਚਲਦੀ ਰਹਿੰਦੀ ਆ ਅਤੇ ਮਿੰਤਰਾ ਬਹੁਤ ਵਧੀਆ ਐਪ ਹੈਗੀ ਹੈ ਉੱਥੇ ਉਹ ਜਿੱਦਾਂ ਦਾ ਪ੍ਰੋਡਕਟ ਹੁੰਦਾ ਉਦਾਂ ਦਾ ਹੀ ਆਉਂਦਾ ਵਾ ਸੇਮ ਐਟਲੀ ਸੇਮ ਆਉਂਦਾ ਅਤੇ ਜਦੋਂ ਮੈਂ ਉਹ ਪਾਇਆ ਸਵੈਟਰ ਉਹ ਇੰਨਾ ਵਧੀਆ ਲੱਗਿਆ ਉਹਦਾ ਕਲਰ ਬਹੁਤ ਵਧੀਆ ਸੀ ਤੇ ਮੈਨੂੰ ਬਹੁਤ ਪਸੰਦ ਆਇਆ ਸਵੈਟਰ ਅਤੇ ਮੈਂ ਅੱਗੇ ਵੀ ਮਿੰਤਰਾ ਤੋਂ ਹੀ ਸ਼ੋਪਿੰਗ ਕਰਾਂਗੀ